ਜੀ ਪੰਜਾਬ ਦੇ ਮਾਲਵੇ ਹਿੱਸੇ ਨੂੰ ਦੇਖੀਏ ਜਿਹੜੇ ਹਿੱਸੇ ਤੋਂ ਮੈਂ ਬਿਲੋਂਗ ਕਰਦਾ ਜਿਹੜੇ ਹਿੱਸੇ 'ਚ ਮੈਂ ਰਹਿੰਦਾ ਇੱਥੇ ਹੀ ਟਰਾਂਸਪੋਰਟ ਦਾ ਜਿਹੜਾ ਮੁੱਖ ਸਾਧਨ ਹੈ ਉਹ ਹਾਲੇ ਵੀ ਜੇ ਆਪਾਂ ਸਰਕਾਰੀ ਤੌਰ 'ਤੇ ਦੇਖੀਏ ਤਾਂ ਉਹ ਟਰਾਂਸਪੋਰਟ ਦਾ ਮੁੱਖ ਸਾਧਨ ਹਾਲੇ ਵੀ ਬੱਸਾਂ ਨੇ ਅਤੇ ਈਸਟਨ ਪ ਪੈਪਸੂ ਨਾਂ ਤੋਂ ਪੰਜਾਬ ਈਸਟਨ ਪ ਪੰਜਾਬ ਪ੍ਰੋਵਿੰਸ ਯੂਨੀਅਨ ਅਤੇ ਬੱਸਾਂ ਦੀ ਇੱਕ ਯੂਨੀਅਨ ਉਹ ਵੀ ਬੱਸਾਂ ਦੀ ਇੱਥੇ ਆਵਾਜਾਈ ਕਰਦੀ ਹੈ ਅਤੇ ਪੰਜਾਬ ਟ੍ਰਾਂਸਪੋਰਟ ਕਾਰਪੋਰੇਸ਼ਨ ਜਿਹੜੀ ਆਪਾਂ ਸਰਕਾਰੀ ਜਿਹੜੀ ਪੰਜਾਬ ਦੀ ਬੱਸਾਂ ਹੈ ਅਤੇ ਸਾਰੀ ਪੰਜਾਬ ਰੋਡਵੇਜ਼ ਹੈ ਉਹ ਵੀ ਓਪਰੇਟ ਕਰਤੀ ਅਤੇ ਮੁੱਖ ਸਾਧਨ ਅਜੇ ਵੀ ਦੇਖੀਏ ਤਾਂ ਆਸੇ ਪਾਸੇ ਆਲੇ ਦੁਆਲੇ ਜਾਣ ਵਾਸਤੇ ਲੋਕਾਂ ਵਾਸਤੇ ਇੱਕ ਵੱਡਾ ਸਾਧਨ ਹਾਲੇ ਵੀ ਬੱਸ ਹੈ ਅਤੇ ਬੱਸ ਤੋਂ ਬਾਅਦ ਜੇ ਆਪਾਂ ਦੇਖੀਏ ਮੌਖਿਕ ਤੌਰ 'ਤੇ ਤਾਂ ਉਹ ਸਭ ਤੋਂ ਵੱਡਾ ਸਾਧਨ ਹਾਲੇ ਵੀ ਰੇਲ ਗੱਡੀਆਂ ਜਿਹੜੀ ਟ੍ਰੇਨਸ ਹੈ ਰੇਲ ਗੱਡੀ ਉਹ ਹੈ ਅਤੇ ਰੇਲ ਗੱਡੀ ਵਿੱਚ ਜੇ ਆਪਾਂ ਆਉਣ ਵਾਲੇ ਜੇ ਹੁਣ ਸਮੇਂ 'ਚ ਦੇਖੀਏ ਤਾਂ ਉਹਨਾਂ ਦੇ ਵਿੱਚ ਟਰੈਕਸ ਦੀ ਤਬਦੀਲੀ ਦੀ ਲੋੜ ਹੈ ਨਵੇਂ ਇੰਜਨਸ ਦੀ ਅਤੇ ਨਵੀਂ ਹਲਕੀ ਬੋਗੀਆਂ ਦੀ ਲੋੜ ਹੈ ਅਤੇ ਕਪਾਟਮੈਂਟਸ ਦੀ ਲੋੜ ਹੈ ਤਾਂ ਕਿ ਸਫਰ ਨੂੰ ਤੇਜ਼ ਅਤੇ ਅਸਾਨ ਬਣਾਇਆ ਜਾ ਸਕੇ ਅਤੇ ਉਹਦੇ ਵਿੱਚ ਸੁਵਿਧਾ ਸੈਕਿੰਡ ਜਿਹੜੀ ਏ ਸੀ ਹੈ ਅਤੇ ਜਿਹੜਾ ਸਲੀਪਰ ਹੈ ਉਹਨਾਂ 'ਚ ਬਹੁਤ ਜ਼ਿਆਦਾ ਭੀੜ ਹੋਣ ਲੱਗ ਗਈ ਜਿਹੜੀ ਜਨਰਲ ਡਿਪਾਰਟਮੈਂਟ ਦੇ ਆ ਬੰਦੇ ਬਿਨਾ ਟਿਕਟ ਤੋਂ ਕਰਦੇ ਆ ਤਾਂ ਸਹੂਲਤਾਂ ਦੀ ਕਮੀ ਨਜ਼ ਨਜਰ ਆਉਂਦੀ ਹੈ ਰੇਲਵੇ ਸਟੇਸ਼ਨ ਤੱਕ ਪਹੁੰਚਦੀ ਵੀ ਹਾਲੇ ਕਮੀ ਹੈ ਅਤੇ ਯੂਨੀਵਰਸਿਟੀ ਹੋਣ ਕਰਕੇ ਇਸ ਇਲਾਕੇ 'ਚ ਮੇਰਾ ਖਿਆਲ ਮੈਟਰੋ ਦੀ ਜਾਂ ਛੋਟੀ ਟਿਊਬ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਕੋਲ ਹੋਰ ਸਹੂਲਤਾਂ ਹੋਣ ਇੱਥੋਂ ਪਹਿਲਾ ਹਵਾਈ ਅੱਡਾ ਦੇਖੀਏ ਤਾਂ ਹਾਲੇ ਕਮਰਸ਼ਲੀ ਤਾਂ ਬਠਿੰਡੇ ਦੇ ਆਸੇ ਆਲੇ ਦੁਆਲੇ ਕੋਈ ਬਹੁਤ ਜ਼ਿਆਦਾ ਡਵੈਲਪ ਨਹੀਂ ਪਰ ਇੱਕ ਏਅਰ ਸਟ੍ਰਿਕ ਖੋਲ੍ਹੀ ਹੈ ਅਤੇ ਇੱਕ ਛੋਟਾ ਹਵਾਈ ਅੱਡਾ ਬਠਿੰਡੇ ਤੋਂ ਲਾਗਿਓ ਬਠਿੰਡੇ ਤੋਂ ਲਾਗਿਓ ਬੀਕਰਮ ਇੱਕ ਬਣਿਆ ਉੱਥੇ ਪਲੇਨ ਦਿੱਲੀ ਨੂੰ ਜਾਂਦੇ ਆ ਪਰ ਉਹ ਵੀ ਓਕੇਜਨਲੀ ਹਰ ਰੋਜ਼ ਨਹੀਂ ਜਾਂਦੇ ਅਤੇ ਹਰ ਵਾਰ ਨੂੰ ਨਹੀਂ ਜਾਂਦੇ ਤਾਂ ਸਾਡੀ ਕਨੈਕਟਿਵਿਟੀ ਦੀ ਜੋ ਸਮੱਸਿਆ ਹਾਲੇ ਵੀ ਉਹ ਬਰਕਰਾਰ